ਹੈਲੋ ਹਾਂਜੀ ਡਰਾਈਵਰ ਸਾਹਿਬ ਹਾਂਜੀ ਭਾਅ ਜੀ ਮੈਂ ਤੁਹਾਨੂੰ ਐਡਰੇਸ ਦਿੱਤਾ ਸੀਗਾ ਪਿੰਡ ਹੂਸੈਨਪੁਰ ਦਾ ਔਰ ਗੁਰਦੁਆਰਾ ਸਾਹਿਬ ਦੇ ਨੇੜੇ ਆਉਣ ਦਾ ਹੈ ਨਾ ਅਤੇ ਤੁਸੀਂ ਪਹੁੰਚ ਗਏ ਹੋ ਗੁਰਦੁਆਰਾ ਸਾਹਿਬ ਕੋਲ ਅਤੇ ਮੈਨੂੰ ਲੱਗਦਾ ਸ਼ਾਇਦ ਤੁਸੀਂ ਫਰੰਟ ਗੇਟ 'ਤੇ ਸ਼ਾਇਦ ਪਹੁੰਚ ਗਏ ਹੋਊਗੇ ਕਿਉਂਕਿ ਮੈਂ ਬੈਕ ਸਾਈਡ 'ਤੇ ਖੜ੍ਹਾ ਕਿਰਪਾ ਕਰਕੇ ਤੁਸੀਂ ਬੈਕ ਗੇਟ 'ਤੇ ਆ ਸਕਦੇ ਹੋ ਬੈਕ ਗੇਟ 'ਤੇ ਆ ਜਾਓ ਥੈਂਕ ਯੂ